ਰੋਜ਼ ਦੇ ਕੰਮਾਂ ਕਾਰਾਂ ਤੋਂ ਇਲਾਵਾ ਮੇਰੇ ਸ਼ੌਂਕ ਅਤੇ ਦਿਲਚਸਪੀ ਦੇ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਬੈਠਣਾ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਨੇ ਅਤੇ ਰੋਜ਼ ਮਿਲਾਪ ਦੀ ਜ਼ਿੰਦਗੀ ਦੇ ਜਾਂ ਗੱਲਾਂ ਕਰਨੀਆਂ ਅਤੇ ਉਹਨਾਂ ਦੇ ਨਾਲ ਘੁੰਮਣਾ ਫਿਰਨਾ ਕੁਝ ਨਵਾਂ ਸਿੱਖਣਾ ਅਤੇ ਉਹਨਾਂ ਨਾਲ ਖਾਣ ਪੀਣ ਬਾਹਰ ਜਾਣਾ ਕੁਝ ਕੁ ਸਮਾਂ ਉਹਨਾਂ ਨਾਲ ਹਾਸੀ ਮਖ਼ੌਲ ਕਰਨਾ ਅਤੇ ਉਹਨਾਂ ਨਾਲ ਕੁਝ ਕੁ ਪਲ ਖੇਡ ਕੇ ਚੰਗੇ ਬਿਤਾਉਣੇ ਜਿਸ ਦੇ ਨਾਲ ਕਿ ਮਾਇੰਡ ਵੀ ਰਿਲੈਕਸ ਰਹਿੰਦਾ ਹੈ ਅਤੇ ਸਾਡੇ ਇਹ ਦਿਮਾਗ ਵੀ ਸ਼ਾਂਤ ਰਹਿੰਦਾ ਹੈ

ਕੰਮ ਤੋਂ ਇਲਾਵਾ ਮੈਨੂੰ ਬਾਹਰ ਘੁੰਮਣਾ ਫਿਰਨਾ ਪਸੰਦ ਹੈ ਅਤੇ ਕੁਝ ਨਵਾਂ ਸਿੱਖਣਾ ਵੀ ਪਸੰਦ ਹੈ